ਸਾਡੇ ਖੇਤਰ ਵਿੱਚ ਬਹੁਤ ਧਰਮਾਂ ਦੇ ਲੋਕ ਰਹਿੰਦੇ ਹਨ ਜੋ ਆਪਸੀ ਪਰਿਵਾਰਿਕ ਹਨ ਇਸਾਈ ਵੀ ਰਹਿੰਦੇ ਹਨ ਸਿੱਖ ਵੀ ਰਹਿੰਦੇ ਹਨ ਮੁਸਲਮਾਨ ਹਿੰਦੂ ਅਸੀਂ ਗੁਰਦੁਆਰੇ ਚਰਚ ਮੰਦਰ ਹਰ ਜਗ੍ਹਾ ਜਾਂਦੇ ਹਾਂ ਉਹ ਵੀ ਸ ਸਾਡੇ ਨਾਲ ਸਾਡਾ ਆਪਸੀ ਮੇਲ ਜੋਲ ਸਾਰਿਆਂ ਦਾ ਬਹੁਤ ਵਧੀਆ ਹੈ ਅਸੀਂ ਸਾਰੇ ਪਾਰਕ ਵਿੱਚ ਇਕੱਠੇ ਬੈਠਦੇ ਹਾਂ ਤਾਂ ਇੱਕ ਦੂਸਰੇ ਨਾਲ ਲੈਣ ਦੇਣ ਖਾਣ ਪੀਣ ਦੀਆਂ ਚੀਜ਼ਾਂ ਤਿਉਹਾਰਾਂ ਦੇ ਇੱਕ ਦੂਸਰੇ ਦੇ ਤਿਉਹਾਰ ਵੀ ਅਸੀਂ ਰਲ ਮਿਲ ਕੇ ਮਨਾਉਂਦੇ ਹਾਂ ਜਦੋਂ ਈਦ ਆਉਂਦੀ ਹੈ ਫਿਰ ਵੱਡਾ ਦੇਣ ਆਉਂਦਾ ਹੈ ਗੁਰਦੁਆਰਿਆਂ ਦੇ ਤਿਉਹਾਰ ਆਉਂਦੇ ਨੇ ਮੰਦਰ ਦਾ ਤਿਉਹਾਰ ਆਉਂਦਾ ਨੇ ਸਾਰੇ ਇੱਕ ਦੂਸਰੇ ਦੇ ਤਿਉਹਾਰਾਂ ਦੇ ਵਿੱਚ ਜਾਂਦੇ ਹਨ ਅਤੇ ਇੱਕ ਦੂਸਰੇ ਦੇ ਤਿਉਹਾਰਾਂ ਨੂੰ ਅਸੀਂ ਰਲ ਮਿਲ ਕੇ ਬਹੁਤ ਚੰਗੀ ਤਰ੍ਹਾਂ ਮਨਾਉਂਦੇ ਹਾਂ ਬਹੁਤ ਸਾਡੇ ਖੇਤਰ ਵਿੱਚ ਹਰ ਧਰਮਾਂ ਦਾ ਪਾਲਣ ਕੀਤਾ ਜਾਂਦਾ ਹੈ ਹਰ ਧਰਮਾਂ ਦੀ ਇੱਜਤ ਭਾਵ ਕੀਤੀ ਜਾਂਦੀ ਹੈ ਅਸੀਂ ਸਾਰੇ ਰਲ ਮਿਲ ਕੇ ਆਪਣੇ ਧਰਮਾਂ ਨਾਲ ਖੁਸ਼ੀਆਂ ਮਾਣਦੇ ਹਾਂ